ਵਿਦਿਆਰਥੀਆਂ ਨੂੰ ਦੂਜੇ ਕਸਬਿਆਂ 'ਚ ਜਾ ਕੇ ਚੁਣੌਤੀਆਂ ਤਾਂ ਆਉਂਦੀਆਂ ਨੇ ਜਿਵੇਂ ਕਿ ਪੰਜ ਕਿਲੋਮੀਟਰ ਦੇ ਏਰੀਆ 'ਚ ਸਰਕਾਰੀ ਸਕੂਲ ਇੱਕੋ ਹੀ ਹੁੰਦਾ ਹੈ ਤਾਂ ਪੰਜ ਕਿਲੋਮੀਟਰ ਦੂਰ ਜਾਣਾ ਪੈਂਦਾ ਜੋ ਕਿ ਪੰਜਵੀਂ ਤੱਕ ਦਾ ਇੱਕੋ ਸਕੂਲ ਹੀ ਹੁੰਦਾ ਹੈ ਕਿ ਹਰੇਕ ਪਿੰਡ 'ਚ ਹੁੰਦਾ ਹੈ ਅਤੇ ਜੋ ਪੰਜਵੀਂ ਸਕੂਲ ਤੋਂ ਬਾਅਦ ਆਉਂਦਾ ਹੈ ਕਸਬਿਆਂ 'ਚ ਉਹ ਪੰਜ ਕਿਲੋਮੀਟਰ ਦੇ ਏਰੀਏ 'ਚ ਇੱਕੋ ਸਕੂਲ ਹੁੰਦਾ ਹੈ ਤਾਂ ਉੱਥੇ ਜਾਣ ਲਈ ਕੋਈ ਨਿਯਮਤ ਬੱਸਾਂ ਨਹੀਂ ਹੁੰਦੀਆਂ ਜਾਂ ਸਹੂਲਤਾਂ ਨਹੀਂ ਹੁੰਦੀਆਂ ਬੱਚਿਆਂ ਨੂੰ ਆਪਣਾ ਸਾਧਨ ਆਪ ਦੇਖਣਾ ਪੈਂਦਾ ਸਾਈਕਲ ਵਗੈਰਾ ਜਾਂ ਹੁਣ ਦੇ ਸਮੇਂ 'ਚ ਮੋਟਰਸਾਈਕਲ ਵਗੈਰਾ ਸਕੂਟੀ ਵਗੈਰਾ ਉਹਦੇ 'ਤੇ ਜਾਈ ਜਾਂਦੇ ਨੇ ਅਤੇ ਇਹਦੇ 'ਚ ਪ੍ਰਾਪਤ ਔਖਾ ਤਾਂ ਹੈ ਪਰ ਜ਼ਿੰਦਗੀ ਦੀ ਸ਼ੁਰੂਆਤ ਵੀ ਅਸੀਂ ਇਸ ਸਕੂਲ ਤੋਂ ਹੀ ਮੰਨੀ ਜਾਂਦੀ ਹੈ ਜੇਕਰ ਅਸੀਂ ਔਕੜਾਂ ਸਹਿ ਕੇ ਸਕੂਲ ਵਿੱਚ ਜਾਂਦੇ ਹਾਂ ਤਾਂ ਇਸ ਨਾਲ ਹੀ ਸਾਨੂੰ ਅੱਗੇ ਮਿਹਨਤ ਕਰਨ ਦੀ ਹਿੰਮਤ ਮਿਲਦੀ ਹੈ ਤਾਂ ਅਸੀਂ ਮਿਹਨਤ ਕਰਦੇ ਰਹਿੰਦੇ ਹਾਂ ਤਾਂ ਔਕੜਾਂ ਤਾਂ ਹੁੰਦੀਆਂ ਨੇ ਅਤੇ ਚੁਣੌਤੀਆਂ ਵੀ ਕਰਨੀਆਂ ਪੈਂਦੀਆਂ ਨੇ ਚੁਣੌਤੀਆਂ ਇਹ ਨੇ ਕਿ ਕਿ ਜਾਣਾ ਆਉਣਾ ਔਖਾ ਕੋਈ ਨਿਯਮ ਅਤੇ ਚੀਜ਼ਾਂ ਸਾਧਨ ਵਗੈਰਾ ਨਹੀਂ ਹੁੰਦੇ ਅਤੇ ਪੰਜ ਕਿਲੋਮੀਟਰ ਏਰੀਏ 'ਚ ਦੂਰ ਜਾਣਾ ਆਉਣਾ ਇਹੀ ਔਕੜਾਂ ਨੇ ਬਸ